ਗਾਇਕੀ ਭਾਵਨਾਵਾਂ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਗਾਇਕੀ ਰਾਹੀਂ ਅਸੀਂ ਆਪਣੇ ਜੋ ਅਸੀਂ ਬੋਲ ਨਹੀਂ ਸਕਦੇ ਉਹ ਵੀ ਅਸੀਂ ਗਾਇਕੀ ਦੁਆਰਾ ਦੱਸ ਸਕਦੇ ਹਾਂ ਜਿਵੇਂ ਅਗਰ ਕਿਸੇ ਨੂੰ ਅਸੀਂ ਪਿਆਰ ਕਰਦੇ ਹਾਂ ਅਤੇ ਉਸਨੂੰ ਕਹਿਣ ਤੋਂ ਡਰਦੇ ਹਾਂ ਬਟ ਗਾਣੇ ਵਿੱਚ ਗਾਣਾ ਗਾ ਕੇ ਅਸੀਂ ਉਸ ਨੂੰ ਦੱਸ ਵੀ ਸਕਦੇ ਹਾਂ ਅਤੇ ਥੋੜ੍ਹਾ ਮਧੁਰ ਵੀ ਲੱਗਦਾ ਹੈ ਜੇ ਕਿਸੇ ਨੂੰ ਗੁੱਸਾ ਆਉਂਦਾ ਹੈ ਜਾਂ ਕੋਈ ਭੜਕੇਲੂ ਟੋਪਿਕ ਤੁਸੀਂ ਜੇ ਬੋਲ ਨਹੀਂ ਸਕਦੇ ਤੁਸੀਂ ਗਾਣੇ ਵਿੱਚ ਕਰ ਸਕਦੇ ਹੋ ਅਗਰ ਤੁਸੀਂ ਪਿਆਣੇ ਪਿਆਰੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਕੋਲ ਜਸ ਮਾਣਕ ਗੁਰੀ ਵਗੈਰਾ ਵੀ ਹਨ ਅਤੇ ਤੁਸੀਂ ਥੋੜ੍ਹੇ ਭੜਕੇਲੂ ਅਤੇ ਲੜਾਈ ਵਾਲੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਕੋਲ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਲੋੜ ਵੀ ਹਨ ਬਾਕੀ ਵੇਖਿਆ ਜਾਵੇ ਤਾਂ ਗਾਣੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਆਪਣੇ ਭਾਵਨਾਵਾਂ ਨੂੰ ਗਾਇਕੀ ਵਿੱਚ ਲਿਖਣ ਲਈ ਕੁਝ ਨਹੀਂ ਕਰਨਾ ਬਸ ਤੁਹਾਨੂੰ ਥੋੜ੍ਹਾ ਜਿਹਾ ਸੁਰ ਅਤੇ ਗਾਇਕੀ ਦਾ ਗੁਣ ਹੋਣਾ ਚਾਹੀਦਾ ਹੈ ਗਾਇਕੀ ਦਾ ਗੁਣ ਇਹ ਕਿ ਤੁਸੀਂ ਕੋਈ ਲਾਈਨ ਖਤਮ ਕਰਦੇ ਹੋ ਅਤੇ ਉਹ ਲੈਣ ਦਾ ਆਖਰੀ ਸ਼ਬਦ ਅਗਲੇ ਗਾਏ ਲਾਈਨ ਦੇ ਆਖਰੀ ਸ਼ਬਦ ਨਾਲ ਮਿਲਣਾ ਚਾਹੀਦਾ ਹੈ ਜਿਵੇਂ ਕਿ ਜਿਊਂਦਾ ਜਾਂਦਾ ਆਉਂਦੀ ਖਾਂਦੀ ਇਸ ਤਰ੍ਹਾਂ ਦੇ ਨਾਲ ਬਾਕੀ ਵੇਖਿਆ ਜਾਵੇ ਤਾਂ ਗਾਇਕੀ ਨਾਲ ਅੱਜ ਕੱਲ੍ਹ ਬਹੁਤ ਲੋਕ ਪੈਸਾ ਕਮਾ ਰਹੇ ਹਨ ਗਾਇਕੀ ਇੱਕ ਬਹੁਤ ਹੀ ਸਾਡਾ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ ਪ੍ਰਾਚੀਨ ਕਾਲ ਤੋਂ ਗਾਇਕੀ ਵਗੈਰਾ ਚੱਲੀ ਆ ਰਹੀ ਹੈ ਬਟ ਸਮੇਂ ਸਰ ਸਮੇਂ ਇਹ ਥੋੜ੍ਹੀ ਬਹੁਤੀ ਆਪਣੇ ਆਪ ਨੂੰ ਬਦਲਦੀ ਰਹਿੰਦੀ ਹੈ